ਮੇਰੇ ਘਰ ਇੱਕ ਪਾਲਤੂ ਜਾਨਵਰ ਕੁੱਤਾ ਹੈ ਜੇ ਜਿਹੜਾ ਕਿ ਬਹੁਤ ਸੋਹਣਾ ਜਿਹਾ ਉਹਨੂੰ ਆਪਾਂ ਲੈ ਆਏ ਹੋਏ ਅਤੇ ਦੋ ਤੋਂ ਢਾਈ ਸਾਲ ਹੋ ਚੁੱਕੇ ਨੇ ਜਿਹਨੇ ਜਿਹਨੇ ਕਿ ਸਾਡੇ ਘਰ 'ਚ ਬਹੁਤ ਸਾਰੀਆਂ ਪਰੇਸ਼ਾਨੀਆਂ ਵੀ ਦੇਖੀਆਂ ਨੇ ਅਤੇ ਖੁਸ਼ੀਆਂ ਵੀ ਦੇਖੀਆਂ ਨੇ ਉਹ ਇੰਨਾਂ ਚੰਗਾ ਅਤੇ ਪਿਆਰਾ ਕੁੱਤਾ ਕਿਸੇ ਨੂੰ ਅੱਜ ਤੱਕ ਪ੍ਰੋਬਲਮ 'ਚ ਦੇਖੇਗਾ ਤਾਂ ਉਹ ਆਪ ਵੀ ਇਮੋਸ਼ਨਲ ਹੋ ਜਾਂਦਾ ਹੈ ਅਤੇ ਇਕ ਕਦੇ ਵੀ ਕਿਸੇ ਨੂੰ ਵੱਢਦਾ ਨਹੀਂ ਹੈ ਇੱਕ ਇਮੋਸ਼ਨਲ ਅਟੈਚਮੈਂਟ ਜਿਹਨੂੰ ਬੋਲਦੇ ਹਾਂ ਉਹ ਸਾਡੇ ਨਾਲ ਉਹਦੀ ਆ ਅਤੇ ਮੇਰੀ ਮੰਮੀ ਪਾ ਪਾ ਸਾਰੇ ਉਹਨੂੰ ਬਹੁਤ ਲਗਾਵ ਨਾਲ ਰੱਖਦੇ ਹਨ ਹਾਂ ਅਤੇ ਉਸ ਉਹਨੇ ਹਰ ਇੱਕ ਤਰੀਕੇ ਦੇ ਨਾਲ ਸਾਨੂੰ ਖੁਸ਼ ਰੱਖਿਆ ਹੈ ਕਿਉਂਕਿ ਕਹਿੰਦੇ ਹਨ ਕਿ ਜੇ ਹਾ ਸਾਡੇ ਕਿਸੇ ਦੇ ਵੀ ਘਰ ਸਾਡੇ ਘਰ ਜਾਂ ਤੁਹਾਡੇ ਘਰ ਕਿਸੇ ਦੇ ਵੀ ਘਰ ਇੱਕ ਪਾਲਤੂ ਜਾਨਵਰ ਹੋਏ ਅਤੇ ਉਹ ਸਾਨੂੰ ਉਹ ਹਰ ਇੱਕ ਪੋਜੀਟੀਵਿਟੀ ਰੱਖਦਾ ਹੈ ਅਤੇ ਨਾਲ ਹੀ ਨਾਲ ਨੈਗੇਟਿਵਿਟੀ ਨੂੰ ਸਾ ਆਪਣੇ ਸਾਡੇ ਘਰੋਂ ਬਾਹਰ ਕੱਢਦਾ ਹਾਂ ਸਾਡੀ ਇੱਕ ਜੁਇੰਟ ਫੈਮਿਲੀ ਹੈ ਜਿਹਦੇ ਵਿੱਚ ਕਿ ਸਾਡੀ ਜ ਮੇਰੀ ਜਿਹੜੀ ਚਾਚੀ ਹੈ ਥੋੜ੍ਹਾ ਜਿਹਾ ਡਰਦੇ ਹੈ ਪਰ ਫਿਰ ਵੀ ਆਪਾਂ ਉਹਨੂੰ ਰੱਖਿਆ ਹੈ ਉਹਨੇ ਸਾਡਾ ਇੱਦਾਂ ਦਾ ਕਿ ਮੀਨਜ਼ ਅਟੈਚਮੈਂਟ ਬਣਾ ਲਈ ਹੈ ਜੇ ਆਪਾਂ ਉਹਨੂੰ ਘਰੋਂ ਜਾਣ ਨੂੰ ਵੀ ਕਹਾਂਗੇ ਤਾਂ ਉਹ ਅ ਆਪਾਂ ਮੈਂ ਮੈਂ ਪੱਕਾ ਰੋਣ ਲੱਗ ਪਵਾਂਗੀ ਪਰ ਅਸੀਂ ਫਿਰ ਵੀ ਉਸ ਚੀਜ਼ ਨੂੰ ਬਹੁਤ ਚੰਗੇ ਤਰੀਕੇ ਨਾਲ ਰੱਖਿਆ ਕਿਉਂਕਿ ਪਸੰਦ ਕਰਨ ਦੀ ਕੋਈ ਵੀ ਹੱਦ ਨਹੀਂ ਹੁੰਦੀ ਹੈ